ਕੰਮ ਸ਼ੁਰੂ ਕਰਨ ਤੋਂ ਪਹਿਲਾਂ ਬੰਦੇ ਕੋਲੇ ਸਾਫ ਹੋਣਾ ਚਾਹੀਦਾ ਹੈ ਅਤੇ ਜੇ ਉਸਨੇ ਪਲੋਟਰੀ ਫਾਰਮ ਖੋਲਣਾ ਹੈ ਤਾਂ ਉਸ ਕੋਲ ਆਪਦੀ ਜਮੀਨ ਹੋਣੀ ਚਾਹੀਦੀ ਹੈ ਅਤੇ ਉਹ ਜ਼ਮੀਨ ਪਿੰਡ ਤੋਂ ਘੱਟੋ ਘੱਟ ਦੋ ਢਾਈ ਕਿਲੋਮੀਟਰ ਦੂਰ ਹੋਣੀ ਚਾਹੀਦੀ ਹੈ ਪੋਲਟਰੀ ਫਾਰਮ ਵਿੱਚੋਂ ਬਹੁਤ ਸਮੈਲ ਆਉਂਦੀ ਹੈ ਜੋ ਕਿ ਆਮ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ ਇਸ ਨਾਲ ਕਈ ਬਿਮਾਰੀਆਂ ਵੀ ਲੱਗ ਸਕਦੀਆਂ ਹਨ ਅਤੇ ਜੇ ਕਿਸੇ ਕੋਲੇ ਪੈਸਾ ਨਹੀਂ ਹੈ ਤਾਂ ਪ੍ਰਧਾਨ ਮੰਤਰੀ ਰੁਜ਼ਗਾਰ ਯੋਜਨਾ ਵਾਲੇ ਇਹੋ ਜਿਹਿਆਂ ਨੂੰ ਲੋਨ ਵੀ ਅਵੋਇਡ ਕਰਦੀ ਹੈ ਅਤੇ ਉਹ ਉਨ ਤੋਂ ਲੋਨ ਲੈ ਕੇ ਆਪਦਾ ਕਾਰੋਬਾਰ ਸ਼ੁਰੂ ਕਰ ਸਕਦੇ ਹਨ